ਪੋਲੀਓ ਇੱਕ ਬਹੁਤ ਹੀ ਭਿਆਨਕ ਬਿਮਾਰੀ ਹੈ ਜਿਹੜੀ ਜੋ ਕਿ ਕਿਸੇ ਨੂੰ ਜ਼ਿੰਦਗੀ ਭਰ ਲਈ ਅਪਾਹਜ ਬਣਾ ਸਕਦੀ ਹੈ ਪੋਲੀਓ ਹਰ ਇੱਕ ਸ਼ਹਿਰ ਪਿੰਡ ਵਿੱਚ ਪਿਲਾਈ ਜਾਂਦੀ ਹੈ ਹਰ ਇੱਕ ਤੋਂ ਪੰਜ ਸਾਲ ਦੇ ਬੱਚੇ ਨੂੰ ਲੈ ਇੱਕ ਤੋਂ ਪੰਜ ਸਾਲ ਦੇ ਬੱਚੇ ਤੱਕ ਇਸ ਨਾਲ ਨਾ ਤਾਂ ਕੋਈ ਭਿਆਨਕ ਬਿਮਾਰੀ ਹੁੰਦੀ ਹੈ ਨਾ ਕਿਸੇ ਨੂੰ ਪੋਲੀਓ ਹੁੰਦਾ ਇਹ ਇਸ ਜੋ ਵੀ ਕੋਈ ਰਹਿ ਜਾਂਦਾ ਉਸਨੂੰ ਪਿੰਡ ਦੀ ਆਸ਼ਾ ਵਰਕਰ ਘਰ ਘਰ ਜਾ ਕੇ ਪੋਲੀਓ ਦੀ ਬੂੰਦ ਪਿਲਾਉਂਦੀ ਹੈ ਇਸ ੲ ਪੋਲੀਓ ਦੀ ਬੂੰਦ ਪਿਲਾਉਣ ਵਿੱਚ ਸਰਕਾਰ ਨੇ ਬਹੁਤ ਜ਼ਿਆਦਾ ਹਦਾਇਤਾਂ ਦਿੱਤੀਆਂ ਗਈਆਂ ਹਨ ਹ ਸਰਕਾਰ ਵੱਲੋਂ ਬਹੁਤ ਸਾਰੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਜਿਵੇਂ ਕਿ ਘਰ ਘਰ ਜਾ ਕੇ ਹਰ ਇੱਕ ਬੱਚੇ ਨੂੰ ਪੋਲੀਓ ਪਿਲਾਇਆ ਜਾਵੇ ਕਿਸੇ ਸੈਂਟਰ ਵਿੱਚ ਬਿਠਾ ਕੇ ਹਰ ਇੱਕ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਹਰ ਇੱਕ ਜੀਰੋ ਤੋਂ ਪੰਜ ਸਾਲ ਦੇ ਬੱਚੇ ਨੂੰ ਪੋਲੀਓ ਦੀ ਬੂੰਦ ਜ਼ਰੂਰ ਪਿਲਾਈ ਜਾਵੇ ਉਹਨਾਂ ਦੇ ਮਾਂ ਬਾਪਾਂ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਕਿ ਆਪਣੇ ਬੱਚੇ ਨੂੰ ਸਾਡੇ ਕੋਲ ਲੈ ਕੇ ਆਉ ਹੋਸਪਿਟਲ ਜਾਂ ਕਿਸੇ ਵੀ ਕ ਸੁਵਿਧਾ ਕੇ ਉਹ 'ਚ ਸੈਂਟਰ ਵਿੱਚ ਵੀ ਆਉ ਅਤੇ ਆਪਣੇ ਬੱਚਿਆਂ ਨੂੰ ਆ ਕੇ ਪੋਲੀਓ ਦੀਆਂ ਬੂੰਦਾਂ ਪਿਲਾ ਪਿਲਾ ਕੇ ਲੈ ਕੇ ਜਾਉ ਪਿਲਾ ਕੇ ਲੈ ਕੇ ਜਾਉ ਅਤੇ ਆਪਣੇ ਬੱਚਿਆਂ ਨੂੰ ਭਿਆਨਕ ਬਿਮਾਰੀਆਂ ਤੋਂ ਜਿੱਦਾਂ ਕਿ ਪੋਲੀਓ ਜਿਸ ਨਾਲ ਕੋਈ ਵੀ ਸਰੀਰ ਦਾ ਅੰਗ ਪੈਰ ਖੜ੍ਹ ਸਕਦਾ ਉਸਨੂੰ ਰੋਕਣ ਲਈ ਪੋਲੀਓ ਦੀ ਬੂੰਦ ਨੂੰ ਜ਼ਰੂਰ ਪਿਲਾਇਆ ਜਾਵੇ ਆਪਣੇ ਬੱਚਿਆਂ ਨੂੰ ਤਾਂ ਕਿ ਉਹਨਾਂ ਦਾ ਬੱਚਾ ਤੰਦਰੁਸਤ ਸਿਹਤਮੰਦ ਹੋ ਸਕੇ ਕਿਸੇ ਵੀ ਅੰਗ ਤੋਂ ਅੰਗਹੀਣ ਨਾ ਹੋਵੇ ਆਪਣੇ ਲਈ ਇੱਕ ਬਹੁਤ ਹੀ ਜ਼ਰੂਰੀ ਅਤੇ ਅਹਿਮ ਚੀਜ਼ ਹੈ ਪੋਲੀਓ ਦੀ ਬੂੰਦ